ਪਿਛਲੇ ਦਿਨੀਂ ਮੈਂ ਸੋਚਿਆ ਕਿ ਮੈਂ ਚੁਪਹਿਰਾ ਸਾਹਿਬ ਇੱਕ ਚੁਪੈ ਸੁੱਖੇ ਹੋਏ ਚੁਪਹਿਰਾ ਸਾਹਿਬ ਵਿੱਚੋਂ ਇੱਕ ਚੁਪਹਿਰਾ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਕਰਨਾ ਹੈ ਇਸ ਕਰਕੇ ਮੈਂ ਆਪਣੇ ਘਰਦਿਆਂ ਨਾਲ ਸਲਾਹ ਕੀਤੀ ਕਿ ਮੈਂ ਅੰਮ੍ਰਿਤਸਰ ਸਾਹਿਬ ਵਿਖੇ ਜਾਣਾ ਹੈ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਨਾ ਹੋਣ ਕਰਕੇ ਉਹ ਮੇਰੇ ਨਾਲ ਨਾ ਜਾ ਸਕੇ ਇਸ ਕਰਕੇ ਮੈਂ ਇਕੱਲੇ ਹੀ ਜਾਣ ਦਾ ਸਾਰਾ ਕੁਛ ਪਲੈਨ ਕੀਤਾ ਅਤੇ ਮੈਂ ਸੈਟਰਡੇ ਨੂੰ ਆਪਣੀ ਸਾਰੀ ਪੈਕਿੰਗ ਕਰ ਲਈ ਅਤੇ ਸੰਡੇ ਮੋਰਨਿੰਗ ਹੀ ਸਵੇਰੇ ਛੇ ਵਜੇ ਖੰਨੇ ਬੱਸ ਸਟੈਂਡ 'ਤੇ ਪਹੁੰਚ ਕੇ ਅੰਮ੍ਰਿਤਸਰ ਸਾਹਿਬ ਦੀ ਬਸ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਬਸ ਆਈ ਤਾਂ ਸਿੱਧੇ ਅੰਮ੍ਰਿਤਸਰ ਸਾਹਿਬ ਵਿਖੇ ਦੀ ਸੀ ਤਾਂ ਫਿਰ ਮੈਂ ਉਸ ਵਿੱਚ ਬੈਠ ਕੇ ਸਿੱਧਾ ਅੰਮ੍ਰਿਤਸਰ ਸਾਹਿਬ ਪਹੁੰਚ ਗਈ ਅਤੇ ਰਸਤੇ ਵਿੱਚ ਜਾਂਦੇ ਹੀ ਮੈਂ ਬਹੁਤ ਹੀ ਪ੍ਰਕਾਰ ਦੇ ਨਵੇਂ ਨਵੇਂ ਚੀਜ਼ਾਂ ਦੇਖੀਆਂ ਜੋ ਮੇਰੇ ਲਈ ਬਹੁਤ ਹੀ ਜ਼ਿਆਦਾ ਨਿਊ ਸੀਗੀਆਂ ਕਿਉਂਕਿ ਮੈਂ ਇਕੱਲੇ ਕਦੇ ਸਫ਼ਰ ਨਹੀਂ ਕੀਤਾ ਸੀਗਾ ਅਤੇ ਅੰਬਰਸਰ ਸਾਹਿਬ ਜੋ ਕਿ ਸਾਡੇ ਕੋਲੋਂ ਲਗਭਗ ਦੋ ਸੌ ਕਿਲੋਮੀਟਰ ਦੂਰ ਹੈ ਉੱਥੇ ਤਾਂ ਬਿਲਕੁਲ ਵੀ ਨਹੀਂ ਕਦੇ ਸੋਚਿਆ ਸੀ ਇਕੱਲੇ ਜਾਣ ਦਾ ਪਰ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਕਿ ਮੈਂ ਕਿੱਧਰ ਨੂੰ ਜਾਵਾਂ ਤਾਂ ਇਸ ਕਰਕੇ ਮੈਂ ਆਪ ਆਪਣੀ ਇਸ ਫਰੈਂਡ ਦੀ ਸਲਾਹ ਦੇ ਮੁਤਾਬਿਕ ਇੱਕ ਕੈਬ ਬੁੱਕ ਕੀਤੀ ਜੋ ਕਿ ਤਕਰੀਬਨ ਦਸ ਮਿੰਟ ਦੇ ਕੋਲ ਮੇਰੇ ਕੋਲ ਪਹੁੰਚ ਗਈ ਅਤੇ ਉਸ ਕੈਬ ਦੇ ਜੋ ਡਰਾਈਵਰ ਸੀਗੇ ਉਹ ਬਹੁਤ ਹੀ ਜ਼ਿਆਦਾ ਨਿਮਰ ਸੁਭਾਅ ਵਾਲੇ ਅਤੇ ਬਹੁਤ ਹੀ ਜ਼ਿਆਦਾ ਉਮਰ ਦੇ ਸੀਗੇ ਉਹ ਬਹੁਤ ਹੀ ਸੂਝਵਾਨ ਵਿਅਕਤੀ ਲੱਗ ਰਹੇ ਸੀਗੇ ਅਤੇ ਸਮਝਦਾਰ ਵੀ ਸੀਗੇ ਉਹਨਾਂ ਨੇ ਮੈਨੂੰ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਬੁਲਾਇਆ ਅਤੇ ਪੁੱਛਿਆ ਮੇਰੇ ਤੋਂ ਪੁੱਛਿਆ ਕਿ ਮੈਂ ਕਿੱਥੋਂ ਦੀ ਵਸਨੀਕ ਹਾਂ ਅਤੇ ਅੰਮ੍ਰਿਤਸਰ ਸਾਹਿਬ ਮੱਥਾ ਟੇਕਣਾ ਹੀ ਆ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਚੁਪਹਿਰਾ ਸਾਹਿਬ ਜੀ ਸੁੱਖੇ ਹੋਏ ਸਨ ਜਿਨ੍ਹਾਂ ਵਿੱਚੋਂ ਮੈਂ ਇੱਕ ਚੁਪਹਿਰਾ ਸਾਹਿਬ ਸੁੱਖਿਆ ਸੀ ਕਿ ਮੈਂ ਅੰਮ੍ਰਿਤਸਰ ਸਾਹਿਬ ਸ਼ੀਸ਼ ਗੰਜ ਵਿਖੇ ਕਰਨਾ ਹੈ ਅਤੇ ਜਿਸ ਕਰਕੇ ਮੈਂ ਇੱਥੇ ਆਈ ਹਾਂ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਘਰ ਦੇ ਮੈਂ ਮੈਂਬਰ ਵੀ ਚੁਪਹਿਰਾ ਸਾਹਿਬ ਕਰਦੇ ਹਨ ਅਤੇ ਚ ਚੁਪਹਿਰਾ ਸਾਹਿਬ ਕਰਨਾ ਬਹੁਤ ਹੀ ਜ਼ਿਆਦਾ ਮਨੋ ਕਾਮਨਾਮਾ ਪੂਰਨ ਹੁੰਦੀਆਂ ਹਨ ਤਾਂ ਉਹਨਾਂ ਨੇ ਮੈਨੂੰ ਬਹੁਤ ਹੀ ਨਿਮਨ ਸੁਭਾਅ ਦੇ ਨਾਲ ਪੂਰੇ ਰਸਤੇ ਵਿੱਚ ਦੱਸਦੇ ਗਏ ਕਿ ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਕੀ ਹੈ ਅਤੇ ਕਿੱਦਾਂ ਕਿੱਦਾਂ ਸਾਰਾ ਕੁਛ ਵਾਪਰਿਆ ਸੀ ਉਹ ਬਹੁਤ ਹੀ ਸਮਝਦਾਰ ਵਿਅਕਤੀ ਲੱਗ ਰਹੇ ਸੀਗੇ ਉਹ ਮੈਨੂੰ ਪੁੱਤਰ ਜੀ ਪੁੱਤਰ ਜੀ ਕਹਿ ਕੇ ਸਾਰਾ ਕੁਛ ਪੁੱਛ ਰਹੇ ਸੀ ਅਤੇ ਮੈਂ ਵੀ ਅੰਕਲ ਜੀ ਅੰਕਲ ਜੀ ਕਹਿ ਕੇ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਸੀਗਾ ਜਿਸ ਹਿਸਾਬ ਨਾਲ ਲੋਕ ਦੱਸਦੇ ਹਨ ਕਿ ਡਰਾਈਵਰਾਂ ਦਾ ਸੁਭਾਅ ਬਹੁਤ ਕੱਬਾ ਅਤੇ ਬਹੁਤ ਹੀ ਅਣਖ ਵਾਲਾ ਹੁੰਦਾ ਹੈ ਉਸ ਹਿਸਾਬ ਨਾਲ ਮੈਨੂੰ ਉਹ ਨਹੀਂ ਸੀ ਲੱਗ ਰਹੇ ਕਿਉਂਕਿ ਸ਼ਾਇਦ ਉਹ ਅੰਮ੍ਰਿਤਸਰ ਦੇ ਹੀ ਸਨ ਅਤੇ ਉਹਨਾਂ ਦੇ ਸੁਭਾਅ ਵਿੱਚ ਬਹੁਤ ਹੀ ਜਿਆਦਾ ਮਿੱਠਾਪਨ ਸੀਗਾ ਜੋ ਕਿ ਮੈਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਸੀਗਾ ਉਹ ਬਿਲਕੁਲ ਮੈਨੂੰ ਮੇਰੇ ਦਾਦਾ ਜੀ ਦੀ ਤਰ੍ਹਾਂ ਲੱਗ ਰਹੇ ਸੀਗੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਚੁਪਹਿਰਾ ਸਾਹਿਬ ਕਰਨ ਵਾਸਤੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਜੀ ਦਾ ਰਸਤਾ ਨਹੀਂ ਪਤਾ ਹੈ ਅਤੇ ਉਹਨਾਂ ਨੂੰ ਮੈਂ ਦੱਸਿਆ ਕਿ ਕੀ ਉਹ ਮੈਨੂੰ ਇਸ ਗੁਰਦੁਆਰੇ ਅੰਮ੍ਰਿਤਸਰ ਵਿਖੇ ਸਾਰੇ ਗੁਰਦੁਆਰਿਆਂ ਵਿੱਚ ਘੁੰਮਾ ਸਕਦੇ ਹਨ ਤਾਂ ਉਹਨਾਂ ਨੇ ਮੈਨੂੰ ਬਹੁਤ ਹੀ ਹਾਮੀ ਭਰਿ ਪਿਆਰ ਭਰੀ ਹਾਮੀ ਦਿੱਤੀ ਕਿ ਉਹ ਮੈਨੂੰ ਸਾਰੇ ਗੁਰਦੁਆਰਿਆਂ ਦਾ ਇਤਿਹਾਸ ਅਤੇ ਗੁਰਦੁਆਰਿਆਂ ਵਿੱਚ ਘੁੰਮਾ ਦੇਣਗੇ ਅਤੇ ਜਦੋਂ ਉਹਨਾਂ ਨੇ ਮੈਨੂੰ ਸਾਰੇ ਆਪਣੇ ਕੰਮ ਪੂਰੇ ਕੀਤੇ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਅੰਤ ਵਿੱਚ ਮੈਂ ਉਹਨਾਂ ਨੂੰ ਅ ਜਿੰਨਾ ਕਰਾਇਆ ਬਣਦਾ ਸੀ ਉਸ ਤੋਂ ਜ਼ਿਆਦਾ ਕੁਝ ਹੋਰ ਟਿੱਪ ਵੀ ਦਿੱਤੀ ਅਤੇ ਮੈਂ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਸ਼ੁਕਰੀਆ ਅਦਾ ਅਤੇ ਧੰਨਵਾਦ ਕੀਤਾ ਕਿ ਉਹਨਾਂ ਨੇ ਮੈਨੂੰ ਇੰਨਾ ਗਿਆਨ ਦਿੱਤਾ ਅਤੇ ਮੈਨੂੰ ਇੰਨਾ ਮੇਰੇ ਉੱਤੇ ਆਪਣਾ ਟਾਈਮ ਦਿੱਤਾ ਵੀ ਕਿ ਉਹਨਾਂ ਨੇ ਮੈਨੂੰ ਇੰਨਾ ਕੁਝ ਸਮਝਾਇਆ ਇੰਨਾ ਕੁਝ ਦੱਸਿਆ ਸੋ